ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਖਬਾਰ ਦੇ ਕਿਹੜੇ ਭਾਗ ਬਾਰੇ ਮੈਂ ਜ਼ਿਆਦਾਤਰ ਪੜ੍ਹਨਾ ਚਾਹੂੰਗੀ ਮੇਰੇ ਕੈਂ ਮੇਰੇ ਮਤਲਬ ਨਾਲ ਮੈਂ ਜੇ ਕਹਿਣਾ ਚਾਹਵਾਂ ਤਾਂ ਮੈਂ ਅਖਬਾਰ ਦੇ ਇੰਟਰਟੇਨਮੈਂਟ ਵਾਲੇ ਭਾਗ ਨੂੰ ਜ਼ਿਆਦਾ ਪੜ੍ਹਨਾ ਚਾਹੂੰਗੀ ਕਿਉਂਕਿ ਉਹ ਭਾਗ ਥੋੜ੍ਹਾ ਮਜ਼ੇਦਾਰ ਹੁੰਦਾ ਹੈ ਅਤੇ ਉਹਦੇ ਵਿੱਚ ਨੈਗੇਟਿਵਿਟੀ ਵੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਐਕਟਰ ਅਤੇ ਐਕਟਰਸਿਸ ਹੁੰਦੇ ਹਨ ਉਹਨਾਂ ਦੀ ਨਿੱਜੀ ਜ਼ਿੰਦਗੀ ਜਾਂ ਉਹਨਾਂ ਦੇ ਨਵੇਂ ਆਉਣ ਵਾਲੇ ਫਿਲਮਾਂ ਗਾਣੇ ਵਗੈਰਾ ਬਾਰੇ ਹੀ ਲਿਖਿਆ ਹੁੰਦਾ ਹੈ ਜੋ ਕਿ ਦੇਖਣ 'ਚ ਅਤੇ ਸੁਣਨ 'ਚ ਬਹੁਤ ਮਜ਼ੇਦਾਰ ਹੁੰਦਾ ਹੈ ਇਸ ਕਰਕੇ ਇਸ ਭਾਗ ਨੂੰ ਪੜ੍ਹਨ 'ਚ ਮਜ਼ਾ ਵੀ ਆਉਂਦਾ ਹੈ ਬਾਕੀ ਜਿੰਨੇ ਵੀ ਭਾਗ ਹੁੰਦੇ ਹਨ ਉਹਦੇ ਵਿੱਚ ਕੁਛ ਨਾ ਕੁਛ ਨੈਗੇਟਿਵ ਹੀ ਲਿਖਿਆ ਹੁੰਦਾ ਹੈ ਪਰ ਇਸ ਭਾਗ ਵਿੱਚ ਬਹੁਤ ਸਾਰੀਆਂ ਪੋਜੀਟਿਵ ਚੀਜ਼ਾਂ ਹੁੰਦੀਆਂ ਹਨ ਜਿੱਦਾਂ ਕਿ ਕੋਈ ਐਕਟਰ ਨੇ ਵਿਆਹ ਕਰਵਾ ਲਿਆ ਉਹਦੇ ਬਾਰੇ ਲਿਖਿਆ ਹੁੰਦਾ ਹੈ ਜਾਂ ਕਿਸੇ ਐਕਟਰਸ ਦੀ ਕਿ ਬੱਚਾ ਹੋਇਆ ਹੈ ਜਾਂ ਕੁਛ ਹੈ ਉਹਦੇ ਬਾਰੇ ਲਿਖਿਆ ਹੁੰਦਾ ਹੈ ਇਹਦੇ ਵਿੱਚ ਜ਼ਿਆਦਾਤਰ ਇਹ ਵੀ ਲਿਖਿਆ ਹੁੰਦਾ ਹੈ ਕਿ ਕਿੰਨੇ ਕਿਹੜੀ ਫਿਲਮ ਨੇ ਕਿੰਨੇ ਪੈਸੇ ਕਮਾਏ ਹਨ ਅਤੇ ਕਿਹੜੇ ਗਾਣੇ ਨੇ ਕਿੰਨੇ ਵਿਊਜ ਲਿੱਤੇ ਹਨ ਅਤੇ ਕਿਹੜਾ ਗਾਣਾ ਪਹਿਲੇ ਨੰਬਰ 'ਤੇ ਹੈ ਹਫਤੇ ਦੇ ਹਿਸਾਬ ਦੇ ਨਾਲ ਇਹ ਵੀ ਲਿਖਿਆ ਹੁੰਦਾ ਹੈ ਜਿਹਦੇ ਨਾਲ ਆਪਾਂ ਜਾਣ ਸਕਦੇ ਹਾਂ ਕਿ ਸਾਡਾ ਫੇਵਰੇਟ ਗਾਣਾ ਪਹਿਲੇ ਨੰਬਰ 'ਤੇ ਹੈ ਜਾਂ ਸਾਡਾ ਫੇਵਰੇਟ ਐਕਟਰ ਦੀ ਕੋਈ ਮੂਵੀ ਜਾਂ ਫਿਰ ਫਿਲਮ ਆ ਰਹੀ ਹੈ ਜਾਂ ਨਹੀਂ ਕਿਉਂਕਿ ਅੱਜ ਕੱਲ੍ਹ ਲੋਕ ਬਹੁਤ ਐਕਸਾਈਟਿਡ ਹੁੰਦੇ ਹਨ ਨਵੀਆਂ ਨਵੀਆਂ ਫਿਲਮਾਂ ਵੇਖਣ ਲਈ ਅਤੇ ਆਪਣੇ ਐਕਟਰ ਨੂੰ ਸਪੋਰਟ ਕਰਨ ਲਈ ਇਸ ਕਰਕੇ ਇਹ ਭਾਗ ਬਹੁਤ ਵਧੀਆ ਹੁੰਦਾ ਹੈ ਇਸ ਭਾਗ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਵੀ ਹੁੰਦੀਆਂ ਹਨ ਜੋ ਸਰੋਤਿਆਂ ਨੂੰ ਜਾਣ ਕੇ ਖੁਸ਼ੀ ਹੁੰਦੀ ਹੈ ਜਿੱਦਾਂ ਕਿ ਕਿਸੇ ਐਕਟਰ ਨੇ ਬਹੁਤ ਸਾਰਾ ਪੈਸਾ ਕਮਾਇਆ ਹੈ ਫਿਲਮ ਤੋਂ ਤਾਂ ਲੋਕ ਬਹੁਤ ਖੁਸ਼ ਹੁੰਦੇ ਹਨ ਕਿਉਂਕਿ ਅੱਜ ਕੱਲ ਫਿਲਮਾਂ ਵੇਖਣ ਦਾ ਸਾਰਿਆਂ ਨੂੰ ਹੀ ਸ਼ੌਕ ਹੁੰਦਾ ਹੈ ਅਤੇ ਇਸ ਭਾਗ ਨੂੰ ਵਧੀਆ ਵਧੀਆ ਤਰੀਕੇ ਦੇ ਨਾਲ ਹੋਰ ਛਾਪਣਾ ਚਾਹੀਦਾ ਹੈ ਥੈਂਕ ਯੂ